ਸਤਿ ਸ਼੍ਰੀ ਅਕਾਲ ਮੈਂ ਅੰਸ਼ ਮਹਾਜਨ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਅੱਜ ਮੈਂ ਤੁਹਾਨੂੰ ਚਿੱਤਰਕਾਰੀ ਦੇ ਵੱਖਰੇ ਵੱਖਰੇ ਤਰੀਕੇ ਦੱਸਣ ਜਾ ਰਿਹਾ ਹਾਂ ਅਤੇ ਆਪਣੇ ਮਨਪਸੰਦ ਤਰੀਕੇ ਬਾਰੇ ਵੀ ਦੱਸਾਂਗਾ ਚਿੱਤਰਕਾਰੀ ਦੇ ਵੈਸੇ ਤੇ ਬਹੁਤ ਸਾਰੇ ਤਰੀਕੇ ਹੁੰਦੇ ਹੈ ਪਰ ਜਿਹੜਾ ਸਭ ਤੋਂ ਆਮ ਤਰੀਕਾ ਵਰਤਿਆ ਜਾਂਦਾ ਹੈ ਉਹ ਹੈ ਵੋਟਰ ਕਲਰ ਪੇਂਟਿੰਗ ਵੋਟਰ ਕਲਰ ਪੇਂਟਿੰਗ ਜਿਹੜੀ ਹੈ ਉਹ ਸਟਾਰਟਿੰਗ ਤੋਂ ਸ਼ੁਰੂਆਤ ਤੋਂ ਹੀ ਸਾਡੇ ਸਕੂਲਾਂ ਵਿੱਚ ਸਿਖਾਈ ਜਾਂਦੀ ਹੈ ਸਾਨੂੰ ਇਸ ਇਸ ਦੇ ਵਿੱਚ ਸਾਨੂੰ ਕੋਰੇ ਕਾਗਜ਼ ਉੱਤੇ ਪਹਿਲੇ ਕੁਛ ਬਣਾਉਣਾ ਹੁੰਦਾ ਹੈ ਪੈਨਸਲ ਨਾਲ ਫਿਰ ਉਹ ਬਣਾਉਣ ਦੇ ਬਾਅਦ ਸਾਨੂੰ ਉਸ ਉੱਤੇ ਵੋਟਰ ਕਲਰ ਫਿਲ ਕਰਨੇ ਹੁੰਦੇ ਹੈ ਇਹ ਬਹੁਤ ਹੀ ਸੌਖੀ ਤਕਨੀਕ ਹੈ ਅਤੇ ਇਹਦੇ ਵਿੱਚ ਜੇ ਤੁਹਾਡੇ ਕੋਲ ਕੋਈ ਕਲਰ ਨਾ ਵੀ ਹੋਵੇ ਤਾਂ ਤੁਸੀਂ ਉਸ ਕਲਰ ਨੂੰ ਬਾਕੀ ਕਲਰ ਮਿਕਸ ਕਰਕੇ ਵੀ ਬਣਾ ਸਕਦੇ ਹੋ ਇਸ ਤਕਨੀਕ ਵਿੱਚ ਜ਼ਿਆਦਾਤਰ ਦੋ ਨੰਬਰ ਤਿੰਨ ਨੰਬਰ ਅਤੇ ਚਾਰ ਨੰਬਰ ਦਾ ਬਰੱਸ਼ ਹੀ ਵਰਤਿਆ ਜਾਂਦਾ ਹੈ ਜੇ ਅਸੀਂ ਆਪਣੀ ਅਗਲੀ ਤਕਨੀਕ ਵਾ ਵੱਲ ਜਾਈਏ ਤਾਂ ਅਗਲੀ ਤਕਨੀਕ ਹੈ ਐਕਰਲੀਕ ਕਲਰ ਤਕਨੀਕ ਐਕਲਰੀਕ ਕਲਰ ਤਕਨੀਕ ਜਿਹੜੀ ਹੈ ਉਹ ਮੇਨਲੀ ਜ਼ਿਆਦਾਤਰ ਪੋਟਰੇਟਸ ਬਣਾਉਣ ਦੇ ਕੰਮ ਆਉਂਦੀ ਹੈ ਉਸ ਦੇ ਵਿੱਚ ਸਾਨੂੰ ਫੈਨ ਬਰੱਸ਼ ਮੋਟਾ ਪੇਂਟਿੰਗ ਬਰੱਸ਼ ਜਿਹੜਾ ਦਸ ਨੰਬਰ ਦਾ ਹੁੰਦਾ ਹੈ ਅਤੇ ਇੱਕ ਦੋ ਕਾਟਨ ਬਡ ਦੀ ਵੀ ਲੋੜ ਪੈ ਜਾਂਦੀ ਹੈ ਇਹ ਪੋਟਰੇਟ ਬਣਾਉਣ ਦੇ ਕੰਮ ਆਉਂਦੀ ਆਈਆਂ ਲੋਕਾਂ ਦੇ ਸਕੈਚ ਬਣਾਉਣ ਦੇ ਕੰਮ ਆਉਂਦੀ ਹੈ ਕਲਰਫੁਲ ਤਰੀਕੇ ਵਿੱਚ ਇਹਦੇ ਬਾਅਦ ਆਉਂਦੀ ਹੈ ਡਰਾਈ ਬਰੱਸ਼ ਤਕਨੀਕ ਡਰਾਈ ਬਰੱਸ਼ ਤਕਨੀਕ ਜਿਹੜੀ ਹੈ ਉਹ ਹਾਈ ਲੈਵਲ ਸੀਨਰੀਆਂ ਬਣਾਉਣ ਦੇ ਕੰਮ ਆਉਂਦੀ ਹੈ ਉਸ ਦੇ ਵਿੱਚ ਅਸੀਂ ਸਿਰਫ ਕਲਰਸ ਦਾ ਇਸਤੇਮਾਲ ਕਰਨਾ ਹੁੰਦਾ ਪਾਣੀ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨੀ ਹੁੰਦੀ ਕਿਉਂਕਿ ਜੇ ਪਾਣੀ ਦੀ ਵਰਤੋਂ ਕਰਤੀ ਤਾਂ ਉਹ ਡਰਾਇੰਗ ਖਰਾਬ ਹੋ ਜਾਂਦੀ ਹੈ ਇਹੀ ਇਸ ਡਰਾਇੰਗ ਦੀ ਬਿਊਟੀ ਹੈ ਅਤੇ ਜੇ ਅਸੀਂ ਆਪਣੀ ਅਗਲੀ ਤਕਨੀਕ ਬਾਰੇ ਦੱਸੀਏ ਤਾਂ ਉਹ ਹੈ ਵਲੈਂਡਿੰਗ ਸਪਰੇ ਪੇਂਟਿੰਗ ਉਸ ਇਹ ਤਕਨੀਕ ਜਿਹੜੀ ਹੈ ਇਸ ਦੇ ਵਿੱਚ ਅਸੀਂ ਸਪਰੇ ਬੋਟਲਸ ਯੂਜ ਕਰਦੇ ਹਾਂ ਜਿਹੜੀ ਰਸਾਇਣਕ ਗੈਸਾਂ ਅਤੇ ਪੇਂਟ ਪੇਂਟਾਂ ਨੂੰ ਮਿਲਾ ਕੇ ਬਣਦੀ ਹੈ ਇਹਦੇ ਵਿੱਚ ਅਸੀਂ ਇੱਕ ਪਲੇਨ ਸ਼ੀਟ 'ਤੇ ਹੀ ਸਪਰੇ ਪੇਂਟਿੰਗ ਕਰ ਕਰਕੇ ਸਪਰੇ ਨਾਲ ਪੇਂਟਿੰਗ ਕਰ ਕਰਕੇ ਇੱਕ ਡਰਾਇੰਗ ਜਾਂ ਫਿਰ ਸੀਨਰੀ ਬਣਾ ਸਕਦੇ ਹਾਂ ਇਹ ਪੇਟਿੰਗ ਬਹੁਤ ਹੀ ਔਖੀ ਹੁੰਦੀ ਹੈ ਕਿਉਂਕਿ ਇਸ ਵਿੱਚ ਸਪਰੇ ਬਾਟਲਸ ਨੂੰ ਹੈਂਡਲ ਕਰਨਾ ਕਾਫੀ ਔਖਾ ਪੈ ਜਾਂਦਾ ਹੈ ਅਤੇ ਇਸ ਦੇ ਬਾਅਦ ਅਸੀਂ ਆਪਣੀ ਆਖਰੀ ਤਕਨੀਕ ਬਾਰੇ ਜਾਈਏ ਤਾਂ ਉਸ ਤਕਨੀਕ ਦਾ ਨਾਮ ਹੈ ਕੈਨੁਆ ਪੈਂਟਿੰਗ ਕੈਨੁਆ ਪੇਂਟਿੰਗ ਜ਼ਿਆਦਾਤਰ ਵੱਡੇ ਵੱਡੇ ਪੇਂਟਰਾਂ ਦੇ ਦੁਆਰਾ ਇਸਤੇਮਾਲ ਕੀਤੀ ਜਾਂਦੀ ਹੈ ਇਸ ਵਿੱਚ ਤਕੜੇ ਤਕੜੇ ਆਰਟ ਪੀਸਿਜ਼ ਬਣਾਉਣ ਵਾਲੇ ਲੋਕ ਵੀ ਸ਼ਾਮਿਲ ਹਨ ਕੈਨੁਆ ਪੇਂਟਿੰਗ ਇੱਕ ਆਮ ਬੰਦੇ ਦਾ ਕੰਮ ਨਹੀਂ ਹੈ ਇਸ ਵਿੱਚ ਸਾਨੂੰ ਕਈ ਤਰ੍ਹਾਂ ਦੇ ਬਰੱਸ਼ ਯੂਜ ਕਰਨੇ ਪੈਂਦੇ ਹਨ ਜਿੱਦਾਂ ਕਿ ਰੋਲਰ ਬਰੱਸ਼ ਹਾਫ ਫੇਸ ਬਰੱਸ਼ ਐਂਗਲ ਬਰੱਸ਼ ਅਤੇ ਆਦਿ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਪੇਂਟ ਵੀ ਯੂਜ ਹੁੰਦੇ ਹਨ ਜੇ ਮੈਂ ਉਹਨਾਂ ਦਾ ਨਾਂ ਦੱਸਣ ਲੱਗਿਆ ਤਾਂ ਸ਼ਾਮ ਹੋ ਜਾਵੇਗੀ ਚਲੋ ਜੋ ਮੈਂ ਦੱਸਣਾ ਸੀ ਉਹ ਤੇ ਮੈਂ ਦੱਸਤਾ ਸ਼ੁਕਰੀਆ